ਬਾਈਕਿੰਗ ਦੀ ਦੁਨੀਆ ਦੇ ਰੁਝਾਨਾਂ ਦੀ ਜੇ ਗੱਲ ਕਰੀਏ ਤਾਂ ਅਗਰ ਖਾਸ ਤੌਰ 'ਤੇ ਭਾਰਤ ਉੱਤੇ ਤਾਂ ਉਹ ਇੱਕ ਸਭ ਤੋਂ ਲੰਬਾ ਰੂਟ ਕਸ਼ਮੀਰ ਤੋਂ ਕੰਨਿਆ ਕੁਮਾਰੀ ਅਤੇ ਜੇ ਅਗਰ ਅਸੀਂ ਪੰਜਾਬ ਤੋਂ ਗੱਲ ਕਰੀਏ ਤਾਂ ਕਪੂਰਥਲੇ ਤੋਂ ਸਿੱਧਾ ਲੇਹ ਲਦਾਖ ਜਿੱਥੋਂ ਕਿ ਹ ਜੋ ਸਾਡਾ ਸਫਰ ਬਣਦਾ ਘੱਟੋ ਘੱਟ ਤੇਰ੍ਹਾਂ ਚੌਦ੍ਹਾਂ ਸੌ ਕਿਲੋਮੀਟਰ ਬਣਦਾ ਹੈ ਆਉਣ ਜਾਣ ਵਿੱਚ ਅਤੇ ਇਸ ਵਿੱਚ ਕਈ ਮੰਜ਼ਿਲਾਂ ਵੀ ਪੈ ਜਾਂਦੀਆਂ ਨੇ ਜਿਵੇਂ ਕਿ ਪੰਜਾਬ ਤੋਂ ਪਹਿਲਾਂ ਪਠਾਨਕੋਟ ਪਠਾਨਕੋਟ ਤੋਂ ਅਸੀਂ ਜੰਮੂ ਜੰਮੂ ਤੋਂ ਅਸੀਂ ਲਦਾਖ ਦੇ ਏਰੀਏ ਵਿੱਚ ਜਾਈਏ ਤਾਂ ਇਹਨਾਂ ਮੰਜ਼ਿਲਾਂ ਉੱਤੇ ਸਾਨੂੰ ਰੁਕ ਕੇ ਜਾਣਾ ਪੈਂਦਾ ਹੈ ਕਿਉਂਕਿ ਬਾਈਕਿੰਗ ਕਰਦੇ ਸਮੇਂ ਸਾਨੂੰ ਕਈ ਗੰਭੀਰ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹਨ ਪੈਂਦਾ ਹੈ ਜਿਵੇਂ ਕਿ ਸਾਡੀ ਪਿੱਠ ਵੀ ਜ਼ਿਆਦਾ ਦੇਰ ਬੈਠਣ ਨਾਲ ਆਕੜ ਜਾਂਦੀ ਹੈ ਜਾਂ ਪੈਟਰੋਲ ਵੀ ਭਰਾਉਣਾ ਪੈਂਦਾ ਹੈ ਬਾਈਕਾਂ ਵਿੱਚ ਅਤੇ ਆਪਣੇ ਆਪਣੇ ਸਮਾਨ ਖਾਣ ਪੀਣ ਲਈ ਵੀ ਸਾਨੂੰ ਰੁਕਣਾ ਪੈਂਦਾ ਹੈ ਅਤੇ ਅਸੀਂ ਜੇ ਗੱਲ ਕਰੀਏ ਤਾਂ ਸਾਡਾ ਜੋ ਪਲੈਨ ਹੈ ਲਗਭਗ ਕਸ਼ਮੀਰ ਤੋਂ ਚੱਲ ਕੇ ਕੰਨਿਆ ਕੁਮਾਰੀ ਤੱਕ ਦਾ ਜੋ ਘੱਟੋ ਕਿਲੋਮੀਟਰਾਂ ਵਿੱਚ ਤਾਂ ਬੱਤੀ ਸੌ ਕਿਲੋਮੀਟਰ ਦੇ ਲਾਗੇ ਛਾਗੇ ਬਣਦਾ ਹੈ ਅਤੇ ਇਸ ਵਿੱਚ ਅਸੀਂ ਘ ਘੱਟੋ ਘੱਟ ਤਿੰਨ ਚਾਰ ਜਣਿਆਂ ਦਾ ਗਰੁੱਪ ਹੈ ਜੋ ਬਾਈਕਿੰਗ ਕਰਕੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਜਾਣਗੇ ਅਤੇ ਸਾਨੂੰ ਉੱਥੇ ਕਈ ਮ ਜੋ ਸ਼ਹਿਰ ਹੈ ਸਾਡੀਆਂ ਉਹ ਮੰਜ਼ਿਲਾਂ ਬਣਨਗੇ ਜਿਵੇਂ ਕਿ ਕਸ਼ਮੀਰ ਤੋਂ ਚੱਲੀਏ ਤਾਂ ਕਸ਼ਮੀਰ ਤੋਂ ਪਹਿਲਾਂ ਅਸੀਂ ਅੰਮ੍ਰਿਤਸਰ ਜਾਵਾਂਗੇ ਅੰਮ੍ਰਿਤਸਰ ਤੋਂ ਅਸੀਂ ਦਿੱਲੀ ਦਿੱਲੀ ਤੋਂ ਅਸੀਂ ਮੱਧਿਆ ਪ੍ਰਦੇਸ਼ ਮੱਧਿਆ ਪ੍ਰਦੇਸ਼ ਤੋਂ ਜਾਂਦੇ ਜਾਂਦੇ ਕੰਨਿਆ ਕੁਮਾਰੀ ਤੱਕ ਪਹੁੰਚਾਂਗੇ ਅਤੇ ਲਗਭਗ ਇਹ ਰੂਟ ਬੱਤੀ ਸੌ ਕਿਲੋਮੀਟਰ ਦੇ ਕੋਲ ਪਵੇਗਾ ਅਤੇ ਇਸ ਵਿੱਚ ਸਾਨੂੰ ਬਹੁਤ ਜ਼ਿਆਦਾ ਗੰਭੀਰ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਰ ਅਸੀਂ ਇਸ ਲਈ ਬਹੁਤ ਜ਼ਿਆਦਾ ਉਤਸ਼ਾਹਿਤ ਹਾਂ ਕਿਉਂਕਿ ਇਹ ਸਾਡੇ ਗਰੁੱਪ ਲਈ ਬਹੁਤ ਹੀ ਬੜੇ ਮਾਣ ਵਾਲੀ ਗੱਲ ਹੋਏਗੀ ਘੱਟੋ ਘੱਟ ਬੱਤੀ ਸੌ ਕਿਲੋਮੀਟਰ ਦਾ ਅਸੀਂ ਸਫਰ ਤੈਅ ਕਰਾਂਗੇ